ਜਦੋਂ ਸਾਡੇ ਕੋਲ ਸਮਾਂ ਘੱਟ ਹੁੰਦਾ ਹੈ ਅਤੇ ਸਵੇਰੇ ਕਿਸੇ ਵੇਲੇ ਮੈਂ ਲੇਟ ਉੱਠਦੀ ਹਾਂ ਅਤੇ ਬੱਚਿਆਂ ਨੂੰ ਸਕੂਲ ਭੇਜਣਾ ਹੁੰਦਾ ਤਾਂ ਮੈਨੂੰ ਕਿਸੇ ਵੇਲੇ ਸਮਝ ਹੀ ਨਹੀਂ ਆਉਂਦੀ ਕਿ ਮੈਂ ਕੀ ਬਣਾਵਾ ਮੈਂ ਫਿਰ ਫਟਾਫਟ ਜੋ ਮੈਨੂੰ ਸਮਝ ਆਉਂਦਾ ਜਾਂ ਪਨੀਰ ਪਿਆ ਥੋੜ੍ਹੀ ਗੋਭੀ ਪਈ ਹੈ ਫਟਾਫਟ ਉਹਨੂੰ ਮਿਕਸ ਕਰਕੇ ਫਟਾਫਟ ਮੈਂ ਪਰੌਂਠੇ ਬਣਾਤੇ ਨਾਲ ਚਾਹ ਬਣਾਤੀ ਕਿ ਬੱਚਿਆਂ ਨੂੰ ਬ੍ਰੇਕਫਾਸਟ ਦੇ ਨਾਲ ਖਾਣ ਨੂੰ ਦੇਤਾ ਨਾਲ ਪੈਕ ਕਰ ਦਿੱਤਾ ਟਾਈਮ ਘੱਟ ਦੇ ਵਿੱਚ ਫਟਾ ਜਲਦੀ ਹੁੰਦੀ ਉਧਰੋਂ ਵੈਨ ਵਾਲੇ ਨੇ ਆਉਣਾ ਹੁੰਦਾ ਕਿਸੇ ਵੇਲੇ ਤਾਂ ਬਿਲਕੁਲ ਹੀ ਸਮਝ ਨਹੀਂ ਆਉਂਦੀ ਫਿਰ ਮੈਂ ਫਟਾਫਟ ਨਮਕ ਅਜਵਾਇਣ ਵਾਲੇ ਪਰੌਂਠੇ ਨਮਕ ਅਜਵਾਇਣ ਤਾਂ ਹਰ ਘਰ ਦੇ ਵਿੱਚ ਅਵੇਲੇਬਲ ਹੁੰਦਾ ਹਮੇਸ਼ਾ ਹੀ ਹੁੰਦਾ ਨਮਕ ਅਜਵਾਇਣ ਵਾਲੇ ਪਰੌਂਠੇ ਨਾਲ ਚਾਹ ਬਣਾਤੀ ਕਿ ਬੱਚੇ ਫਟਾਫਟ ਮਤਲਬ ਕਿ ਖਾ ਕੇ ਚਲੋ ਚਲੇ ਜਾਣ ਨਾਲ ਪੈਕ ਵੀ ਕਰ ਦਿੱਤੇ ਹੋਰ ਬਿਲਕੁਲ ਸਮਝ ਨਾ ਆਵੇ ਤਾਂ ਜੇ ਬਾਏ ਚਾਂਸ ਰਾਤ ਦੀ ਕੋਈ ਸਬਜ਼ੀ ਥੋੜ੍ਹੀ ਪਈ ਹੈ ਉਹਨੂੰ ਨਾਲ ਥੋੜ੍ਹਾ ਗਰਮ ਕੀਤਾ ਅਤੇ ਚਲੋ ਉਹ ਵੀ ਨਾਲ ਰੋਟੀ ਸਬਜ਼ੀ ਦੇ ਨਾਲ ਦੇ ਕੇ ਕਿ ਮਤਲਬ ਕਿ ਚਲੋ ਗੁਜ਼ਾਰਾ ਹੋ ਜਾਂਦਾ ਕਿ ਸਮੇਂ ਨੂੰ ਸਮਾਂ ਘੱਟ ਕਰਕੇ ਵੈਨ ਵਾਲੇ ਵੀ ਜਲਦੀ ਆ ਜਾਂਦੇ ਆ ਫਿਰ ਉਹ ਸਵੇਰੇ ਬਹੁਤ ਜ਼ਿਆਦਾ ਜਲਦੀ ਹੁੰਦੀ ਹੈ ਕਈ ਵਾਰੀ ਹਸਬੈਂਡ ਨੇ ਜਾਣਾ ਹੁੰਦਾ ਫਿਰ ਸਮਝ ਨਹੀਂ ਆਉਂਦੀ ਫਿਰ ਕਈ ਵਾਰੀ ਤਾਂ ਫਟਾਫਟ ਪਿਆਜ਼ ਟਮਾਟਰ ਦੀ ਸਬਜ਼ੀ ਹੀ ਬਹੁਤ ਘੱਟ ਸਮੇਂ ਵਿੱਚ ਬਣ ਜਾਂਦੀ ਹੈ ਫਟਾਫਟ ਪਿਆਜ਼ ਭੁੰਨ ਕੇ ਜਾਂ ਟਮਾਟਰ ਭੁੰਨ ਕੇ ਮਸਾਲਾ ਸਾਰਾ ਪਾ ਕੇ ਨਾਲ ਕੁਛ ਲੱਭੇ ਤਾਂ ਫਟਾਫਟ ਹੀ ਉਹ ਸਬਜ਼ੀ ਬਣ ਜਾਂਦੀ ਹੈ ਕਿ ਉਹਦੇ ਨਾਲ ਵੀ ਰੋਟੀ ਬਣ ਜਾਂਦੀ ਹੈ ਨਾਲ ਤਾਂ ਹੋਰ ਵੀ ਜਲਦੀ ਕਰਨਾ ਹੋਵੇ ਤਾਂ ਫਟਾਫਟ ਜਾਂ ਤਾਂ ਆਲੂ ਉਬਲੇ ਹੋਏ ਹੋਣ ਤਾਂ ਤਾਂ ਵੀ ਫਟਾਫਟ ਜ਼ੀਰੇ ਵਾਲੇ ਆਲੂ ਵੀ ਮੈਂ ਬਣਾ ਕੇ ਦਸ ਪੰਜ ਮਿੰਟ ਦੇ ਵਿੱਚ ਉਹ ਵੀ ਤਿਆਰ ਹੋ ਜਾਂਦੇ ਉਹਦੇ ਵਿੱਚ ਵੀ ਕੋਈ ਲੰਬਾ ਕੰਮ ਨਹੀਂ ਹੁੰਦਾ